ਸ਼ਹਿਰਾਂ ਵਿੱਚ ਸਹੂਲਤਾਂ ਬਹੁਤ ਜ਼ਿਆਦਾ ਹੁੰਦੀਆਂ ਹੈ ਅਤੇ ਪਿੰਡਾਂ ਵਿੱਚ ਸਹੂਲਤਾਂ ਦੀ ਕਮੀ ਬਹੁਤ ਘੱਟ ਹੁੰਦੀ ਹੈ ਜਿਵੇਂ ਸ਼ਹਿਰਾਂ ਵਿੱਚ ਨੌਕਰੀ ਆਵਾਜਾਈ ਦਾ ਸਾਧਨ ਜ਼ਿਆਦਾ ਹੁੰਦਾ ਹੈ ਅਤੇ ਪਿੰਡਾਂ ਵਿੱਚ ਨੌਕਰੀ ਆਵਾਜਾਈ ਦਾ ਸਾਧਨ ਘੱਟ ਹੁੰਦਾ ਹੈ ਇਸ ਕਰਕੇ ਸ਼ਹਿਰ ਵਿੱਚ ਲੋਕ ਜ਼ਿਆਦਾ ਰਹਿਣਾ ਪਸੰਦ ਕਰਦੇ ਹਨ ਅਤੇ ਪਿੰਡਾਂ ਵਿੱਚ ਰਹਿਣਾ ਘੱਟ ਪਸੰਦ ਕਰਦੇ ਹਨ ਕਿਉਂਕਿ ਸ਼ਹਿਰਾਂ ਵਿੱਚ ਹਰੇਕ ਤਰ੍ਹਾਂ ਦੀ ਸਹੂਲਤ ਮਿਲ ਜਾਂਦੀ ਹੈ ਅਤੇ ਪਿੰਡਾਂ ਵਿੱਚ ਸਹੂਲਤਾਂ ਬਹੁਤ ਘੱਟ ਹੁੰਦੀਆਂ ਹੈ ਜਿਵੇਂ ਸ਼ਹਿਰਾਂ ਵਿੱਚ ਹੋਸਪਿਟਲ ਨੇੜੇ ਹੁੰਦਾ ਹੈ ਅਤੇ ਦਵਾਈ ਬੂਟੀ ਛੇਤੀ ਮਿਲ ਜਾਂਦੀ ਹੈ ਅਤੇ ਜਿਵੇਂ ਪਿੰਡਾਂ ਵਿੱਚ ਹੋਸਪਿਟਲ ਨਹੀਂ ਹੁੰਦਾ ਡਿਸਪੈਂਸਰੀ ਆਦਿ ਹੁੰਦਾ ਹੈ ਅਤੇ ਦਵਾਈ ਬੂਟੀ ਦੀ ਬਹੁਤ ਕਮੀ ਪੇਸ਼ੀ ਘੱਟ ਹੁੰਦੀ ਹੈ ਇਸ ਕਰਕੇ ਲੋਕ ਸ਼ਹਿਰਾਂ ਵਿੱਚ ਰਹਿਣਾ ਜ਼ਿਆਦਾ ਪਸੰਦ ਕਰਦੇ ਹਨ ਅਤੇ ਪਿੰਡਾਂ ਵਿੱਚ ਰਹਿਣਾ ਬਹੁਤ ਘੱਟ ਪਸੰਦ ਕਰਦੇ ਹਨ ਇਸ ਕਰਕੇ ਸ਼ਹਿਰ ਨੂੰ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ